ਕਈ ਸਾਲਾਂ ਤੋਂ ਜੋਗਾ ਕਰ ਰਿਹਾ ਹਾਂ ਅਤੇ ਮੈਂ ਦੇਖਿਆ ਹੈ ਕਿ ਇਸ ਨੇ ਮੇਰੇ ਨੀਂਦ ਤੇ ਬਹੁਤ ਸੁਕਰਾਤਮਕ ਪ੍ਰਭਾਵ ਪਾਇਆ ਹੈ ਅਤੇ ਪਹਿਲਾ ਮੈਨੂੰ ਰਾਤ ਨੂੰ ਸੌਣ ਵਿੱਚ ਮੁਸ਼ਕਿਲ ਆਉਂਦੀ ਸੀ ਮੈਂ ਅਕਸਰ ਰਾਤ ਨੂੰ ਜਾਗਦਾ ਰਹਿੰਦਾ ਸੀ ਪਰ ਜਦੋਂ ਤੋਂ ਮੈਂ ਜੋਗਾ ਕਰਨਾ ਸ਼ੁਰੂ ਕੀਤਾ ਮੈਂ ਦੇਖਿਆ ਕਿ ਰਾਤ ਨੂੰ ਬਹੁਤ ਹੀ ਵਧੀਆ ਸੌਂਦਾ ਹਾਂ ਅਤੇ ਮੈਂ ਘੱਟ ਵਾਰ ਜਾਗਦਾ ਹਾਂ ਇਸ ਤੋਂ ਇਲਾਵਾ ਮੇਰੀ ਨੀਂਦ ਦੀ ਗੁਣਵੱਤਾ ਵਿੱਚ ਵੀ ਬਹੁਤ ਹੀ ਸੁਧਾਰ ਹੋਇਆ ਹੈ ਮੈਂ ਸਵੇਰੇ ਤਾਜ਼ਾ ਤਾਜ਼ਾ ਉਰ ਜਾਵਾਨ ਮਹਿਸੂਸ ਕਰਦਾ ਹਾਂ ਮੇਰੀ ਯੋਗਾ ਰੂਟੀਨ ਵਿੱਚ ਕਈ ਅਜਿਹੇ ਅਭਿਆਸ ਅਤੇ ਤਕਨੀਕਾਂ ਹਨ ਜੋ ਬੇਹਤਰ ਨੀਂਦ ਵਿੱਚ ਯੋਗਦਾਨ ਪਾਉਂਦੀਆਂ ਹਨ ਸਭ ਤੋਂ ਪਹਿਲਾਂ ਮੈਂ ਹਰ ਰੋਜ਼ ਸ਼ਾਮ ਨੂੰ ਕੁਝ ਜੋਗਾ ਆਸਨ ਕਰਦਾ ਹਾਂ ਇਹ ਕੀ ਆਸਨ ਮੇਰੇ ਸਰੀਰ ਨੂੰ ਆਰਾਮ ਦੇਣ ਅਤੇ ਮੇਰੇ ਤਨਾਅ ਨੂੰ ਘਟਾਉਣ ਵਿੱਚ ਮਦਦ ਕਰਨ ਮੇਰੇ ਲਈ ਸਭ ਤੋਂ ਪ੍ਰਭਾਵਸ਼ਾਲੀ ਅਭਿਭਾਸ਼ਾ ਵਿੱਚੋਂ ਇੱਕ ਸ਼ਬ ਆਸਨ ਇਹ ਇੱਕ ਅਰਾਮਦਾਇਕ ਆਸਨ ਹੈ ਜੋ ਮੈਨੂੰ ਸੋਹਣ ਤੋਂ ਪਹਿਲਾਂ ਆਪਣੇ ਸਰੀਰ ਅਤੇ ਮਨ ਨੂੰ ਰਾਮ ਦੇਣ ਵਿੱਚ ਮਦਦ ਕਰਦਾ ਹੈ ਮੈਂ ਸ਼ਵਾਸਨ ਨੂੰ ਲਗਭਗ ਦੱਸ ਮਿੰਟਾਂ ਲਈ ਕਰਦਾ ਹਾਂ ਅਤੇ ਹਮੇਸ਼ਾ ਇਸ ਤੋਂ ਬਾਅਦ ਬਹੁਤ ਹੀ ਰਾਮਦਾਇਕ ਮਹਿਸੂਸ ਕਰਦਾ ਹਾਂ